ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਬਾਈ ਹਨ ਜਿਹਨਾਂ ਵਿੱਚੋਂ ਹਿੰਦੀ ਤਾਮਿਲ ਗੁਜਰਾਤੀ ਸਿੰਧੀ ਪੰਜਾਬੀ ਉਰਦੂ ਹੈ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਜਿਵੇਂ ਕਿ ਤਾਮਿਲਨਾਡੂ ਵਿੱਚ ਤਾਮਿਲ ਭਾਸ਼ਾ ਬੋਲੀ ਜਾਂਦੀ ਹੈ ਗੁਜਰਾਤ ਵਿੱਚ ਗੁਜਰਾਤੀ ਭਾਸ਼ਾ ਬੋਲੀ ਜਾਂਦੀ ਹੈ ਸਿੰਧ ਵਿੱਚ ਸਿੰਧੀ ਭਾਸ਼ਾ ਬੋਲੀ ਜਾਂਦੀ ਹੈ ਉਰਦੂ ਜੋ ਕਿ ਜੰਮੂ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ ਜੇਕਰ ਅਸੀਂ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਪੰਜਾਬ ਵਿੱਚ ਬੋਲੀ ਜਾਂਦੀ ਹੈ ਇਸ ਪੰਜਾਬ ਵਿੱਚ ਦੀਆਂ ਉਪਭਾਸ਼ਾਵਾਂ ਪੁਆਧੀ ਮਾਝੀ ਦੁਆਬੀ ਆਲਬ ਅ ਅ ਆਦਿ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਹਰ ਵੀਹ ਤੀਹ ਕਿਲੋਮੀਟਰ 'ਤੇ ਪੰਜਾਬ ਵਿੱੱਚ ਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਹਨ ਪੰਜਾਬ ਤੋਂ ਅਸੀਂ ਸ਼ੁਰੂ ਤੋਂ ਹੀ ਪੰਜਾਬੀ ਵਿੱਚ ਪੜ੍ਹਦੇ ਆ ਰਹੇ ਹਾਂ ਜੋ ਕਿ ਵਧੀਆ ਭਾਸ਼ਾ ਹੈ